ਮੇਰੀ ਗਾਇਕੀ ਦੀ ਤਕਨੀਕ ਦੇ ਅਭਿਆਸ ਲਈ ਮੈਂ ਹਰ ਰੋਜ਼ ਨਿਯਮਤ ਤੌਰ ਤੇ ਪਰਿਆਸ ਕਰਦਾ ਹਾਂ ਮੈਂ ਆਪਣੀ ਸੁਰ ਅਤੇ ਲੈਅ ਤਕਨੀਕੀਆਂ ਨੂੰ ਸਧਾਰਨ ਲਈ ਵੱਖ ਵੱਖ ਵਾਰਮਅੱਪ ਐਕਸਰਸਾਈਜ਼ ਕਰਦਾ ਹਾਂ ਮੈਂ ਆਪਣੇ ਗਾਣੇ ਦੀ ਰਿਕਾਰਡਿੰਗ ਸੁਣਦਾ ਹਾਂ ਉਹਨਾਂ ਵਿੱਚੋਂ ਸੁਧਾਰ ਕਰਨ ਦੀ ਮੈਂ ਕੋਸ਼ਿਸ਼ ਕਰਦਾ ਹਾਂ ਮੁਸ਼ਕਲ ਚੀਜ਼ਾਂ ਵਿੱਚੋਂ ਇੱਕ ਚੀਜ਼ ਹੈ ਸਹੀ ਸੁਰ ਸਹੀ ਤਾਲ ਕਾਬੂ ਕਰਨਾ ਜੋ ਕਿ ਕਈ ਵਾਰ ਮੁਸ਼ਕਿਲ ਹੋ ਜਾਂਦਾ ਹੈ ਇਸ ਲਈ ਮੈਂ ਸਬਰ ਅਤੇ ਨਿਰੰਤਰ ਅਭਿਆਸ ਨਾਲ਼ ਇਹਨਾਂ ਚੁਣੋਤੀਆਂ ਨੂੰ ਪਾਰ ਕਰ ਲੈਣ ਕਰ ਲੈਂਦਾ ਹਾਂ ਮੇਰਾ ਦਿਨ ਦਾ ਰਿਆਸ ਇਹ ਹੈ ਮੈਂ ਹਰ ਰੋਜ਼ ਨਿਯਮਤ ਤੌਰ ਤੇ ਗਾਇਕੀ ਦੀ ਤਕਨੀਕ ਦੀ ਤਕਨੀਕੀ ਦਾ ਅਭਿਆਸ ਕਰਦਾ ਹਾਂ ਇਸ ਸੁਧਾਰਨ ਸੁਰ ਬਲੀ ਕਸਰਤਾਂ ਨਾਲ਼ ਸ਼ੁਰੂ ਕੀਤਾ ਜਾਂਦਾ ਹੈ ਜਿਵੇਂ ਕਿ ਅਲੰਕਾਰ ਸੁਰ ਸਾਧਨਾਂ ਅੱਗੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਸੁਰ ਅਤੇ ਲੈਅ ਅਭਿਆਸ ਨੇ ਸਹੀ ਸੁਰ ਸੁਧਾਰਨ ਲਈ ਹਰ ਸੁਰ ਦੀ ਵਰਤੋਂ ਕਰਦਾ ਹਾਂ ਮੈਂ ਵੱਖ ਵੱਖ ਰਾਗਾਂ ਅਤੇ ਗੀਤਾਂ ਦੇ ਅਭਿਆਸ ਕਰਦਾ ਹਾਂ ਜੋ ਕਿ ਮੇਰੀ ਵੱਖਰੀ ਗਾਇਕੀ ਨੂੰ ਮਜ਼ਬੂਤ ਕਰਦੇ ਹਨ ਮੈਂ ਸਹੀ ਲੈਅ ਦੀ ਤਕਨੀਕ ਉਮਰ ਹੈ ਰੈਗੂਲਰ ਰੈਗੂਲਰ ਤੋਰ 'ਤੇ ਹਰ ਤਰੀਕੇ ਨਾਲ਼ ਵੀ ਧਿਆਨ ਦਿੰਦਾ ਹਾਂ ਇਹਨਾਂ ਨੂੰ ਸੁਧਾਰਨ ਲਈ ਵੱਖ ਵੱਖ ਕਸ਼ਰਤਾਂ ਕਰਦਾ ਹਾਂ ਜਿਵੇਂ ਸਾਹ ਲੈਣਾ ਸਾਹ ਨੂੰ ਰੋਕਣਾ ਛੱਡਣਾ ਦੀ ਪ੍ਰਕਿਰਿਆ ਮੈਂ ਯੋਗਾ ਵੀ ਕਰਦਾ ਹਾਂ ਅਤੇ ਸੁਬਹਾ ਸਵੇਰੇ ਮੈਂ ਮਾਰਨਿੰਗ ਵਾਕ ਅਤੇ ਈਵਨਿੰਗ ਵਾਕ ਸ਼ਾਮ ਸਵੇਰੇ ਉਹ ਵੀ ਕਰਦਾ ਹਾਂ ਅਤੇ ਖਾਣੇ ਵਿੱਚ ਤਲੀਆਂ ਚੀਜ਼ਾਂ ਮਸਾਲੇਦਾਰ ਅਤੇ ਠੰਡੇ ਪਦਾਰਥਾਂ ਦੀ ਵਰਤੋਂ ਬਿਲਕੁਲ ਵੀ ਨਹੀਂ ਕਰਦਾ ਮੈਂ ਰਿਕਾਰਡਿੰਗ ਅਤੇ ਬੋਲਣ ਲਈ ਆਪਣੇ ਗਲੇ ਨੂੰ ਮਲੱਠੀ ਵਗੈਰਾ ਚੱਬ ਕੇ ਅਤੇ ਗਲੇ ਨੂੰ ਸਾਫ਼ ਕਰਦਾ ਹਾਂ ਅਤੇ ਆਪਣੇ ਗਾਣੇ ਨੂੰ ਗਾ ਕੇ ਸੁਣਦਾ ਹਾਂ ਅਤੇ ਉਹਨਾਂ ਨੂੰ ਸੁਧਾਰਨ ਦੀ ਪੂਰੀ ਪੂਰੀ ਤਨਦੇਹੀ ਕੰਮ ਕਰਦਾ ਹਾਂ ਇਸ ਤਰ੍ਹਾਂ ਜੋ ਮੁਸ਼ਕਲਾਂ ਆਉਂਦੀਆਂ ਹਨ ਉਹਨਾਂ ਨੂੰ ਵੀ ਮੈਂ ਭਲੀ ਭਾਂਤੀ ਜਾਣਦਾ ਹਾਂ ਕਈ ਵਾਰ ਸਹੀ ਸੁਰ ਸਹੀ ਤਾਲ ਪਕੜਿਆ ਜਾਣਾ ਉਸ ਵਿੱਚ ਬੜੀ ਮੁਸ਼ਕਿਲ ਹੋ ਜਾਂਦੀ ਹੈ ਖ਼ਾਸ ਕਰ ਉਦੋਂ ਜਦੋਂ ਗਾਣਾ ਬਹੁਤ ਹੀ ਤਕਨੀਕੀ ਵਾਲਾ ਹੁੰਦਾ ਹੈ ਜਦੋਂ ਵਿਆਮ ਸਹੀ ਤਰੀਕੇ ਨਾਲ਼ ਨਾ ਕੀਤਾ ਹੋਵੇ ਤਾਂ ਗਲਾ ਜਲਦੀ ਸੁੱਕ ਜਾਂਦਾ ਹੈ ਅਤੇ ਥੱਕ ਜਾਂਦਾ ਹੈ ਜ਼ਿਆਦਾ ਬੋਲਿਆ ਨਹੀਂ ਜਾਂਦਾ ਅਤੇ ਗਾਇਆ ਵੀ ਨਹੀਂ ਜਾਂਦਾ ਜਿਸ ਨਾਲ਼ ਗਲੇ ਨੂੰ ਕਾਫ਼ੀ ਮੁਸ਼ਕਿਲ ਪੇਸ਼ ਆਉਂਦੀ ਹੈ ਇਹਨਾਂ ਮੁਸ਼ਕਲਾਂ ਨੂੰ ਦੂਰ ਕਰਨ ਲਈ ਮੇਰੇ ਉਸਤਾਦ ਜੀ ਗੁਰੂ ਜੀ ਤੋਂ ਵੀ ਕੁੱਝ ਸਿੱਖਣ ਦੀ ਸਲਾਹ ਲੈਂਦਾ ਹਾਂ ਮੇਰੇ ਗੁਰੂ ਜੀ ਅਤੇ ਉਸਤਾਦ ਜੀ ਮੈਨੂੰ ਚੰਡ ਕੇ ਬੜਾ ਲਹਿਜੇ ਤਰੀਕੇ ਨਾਲ਼ ਮੈਨੂੰ ਮਤਲਬ ਸਮਝਾਉਣ ਦੀ ਪੂਰੀ ਕੋਸ਼ਿਸ਼ ਕਰਦੇ ਹਨ ਤਾਂ ਕਿ ਜਿਹੜਾ ਇਹ ਗਾਇਕੀ ਦਾ ਅਭਿਆਸ ਹੈ ਇਹਨੂੰ ਮੈਂ ਸਹੀ ਤਰੀਕੇ ਨਾਲ਼ ਕਰ ਸਕਾਂ ਆਪ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਥੈਂਕਯੂ